ਪੰਜਾਬ ਵਿੱਚ ਵੱਧ ਰਹੇ ਪਲਿਊਸ਼ਨ ਦੇ ਵਿੱਚ ਆ ਰਹੀ ਗਿਰਾਵਟ ਨੂੰ ਆਪਾਂ ਕੁਝ ਸੁਝਾਵਾਂ ਦੇ ਤਹਿਤ ਠੀਕ ਕਰ ਸਕਦੇ ਹਾਂ ਜਿਵੇਂ ਕਿ ਰੋਡ ਬਣਨ ਸੜਕਾਂ ਬਣਨ ਦੇ ਨਾਲ ਆਹ ਸਾਈਡਾਂ ਤੋਂ ਦਰਖਤ ਕੱਟੇ ਜਾ ਰਹੇ ਨੇ ਜਿਹਦੇ ਨਾਲ ਪਲਿਊਸ਼ਨ ਵੱਧ ਰਿਹਾ ਹੈ ਕਿਸਾਨਾਂ ਵੱਲੋਂ ਜੋ ਵੀ ਖੇਤੀਬਾੜੀ ਤੋਂ ਬਾਅਦ ਬਚੀ ਹੋਈ ਖਾਦ ਸਮ ਸਮੱਗਰੀ ਜਿਵੇਂ ਕਿ ਝੋਨੇ ਦੀ ਪਰਾਲੀ ਕਣਕ ਦਾ ਨਾੜ ਆਦਿਕ ਨੂੰ ਅੱਗ ਲਾਉਣ ਦੇ ਨਾਲ ਵੀ ਬਹੁਤ ਜ਼ਿਆਦਾ ਪਲਿਊਸ਼ਨ ਵੱਧ ਰਿਹਾ ਹੈ ਅਤੇ ਨਾਲ ਹੀ ਨਾਲ ਸਾਡੇ ਪੰਜਾਬ ਦੇ ਪਾਣੀ ਗੰਧਲੇ ਹੋ ਰਹੇ ਨੇ ਇਹਨਾਂ ਨੂੰ ਸਾਫ ਕਰਨ ਵਾਸਤੇ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਫਿਰ ਵੀ ਅਜੇ ਪ੍ਰੋਪਰ ਤੌਰ 'ਤੇ ਪੂਰੇ ਤੌਰ 'ਤੇ ਇਹਨਾਂ ਨੂੰ ਸਾਫ ਨਹੀਂ ਕੀਤਾ ਜਾ ਰਿਹਾ ਪਲਿਊਸ਼ਨ ਜ਼ਿਆਦਾ ਵਧਣ ਦੇ ਕਾਰਨ ਨੂੰ ਮੁੱਖ ਰੱਖਦੇ ਹੋਏ ਸਰਕਾਰਾਂ ਵੀ ਕਾਫੀ ਕੋਸ਼ਿਸ਼ ਕਰ ਰਹੀਆਂ ਨੇ ਪਰ ਫਿਰ ਵੀ ਕੁਛ ਨਾ ਕੁਛ ਕਿਸੇ ਨਾ ਕਿਸੇ ਹੱਦ 'ਤੇ ਕੁਝ ਨਾ ਕੁਝ ਰਹਿ ਹੀ ਜਾਂਦਾ ਹੈ ਨਾਲ ਹੀ ਨਾਲ ਇਸ ਦਾ ਸਿੱਧਾ ਅਸਰ ਵਪਾਰਕ ਖੇਤਰ ਵਿੱਚ ਵੀ ਪੈਂਦਾ ਹੈ ਵਪਾਰਕ ਖੇਤਰ 'ਤੇ ਇਸ ਤਰ੍ਹਾਂ ਪੈਂਦਾ ਹੈ ਕਿ ਜਿਵੇਂ ਆਪਾਂ ਕੱਪੜੇ ਦਾ ਸਮਾਨ ਬਣਾਉਂਦੇ ਹਾਂ ਕਪਾਹ ਤੋਂ ਕਪਾਹ ਦੀ ਜਿਹੜੀ ਹੈ ਉਹ ਸੁੰਡੀ ਹੀ ਉਸ ਨੂੰ ਪੰਜਾਬ ਵਿੱਚ ਖਰਾਬ ਕਰ ਜਾਂਦੀ ਹੈ ਨਾ ਕਿ ਉਸ ਦੀ ਦੁਆਰਾ ਪੈਦਾਵਾਰ ਵੀ ਘੱਟ ਹੁੰਦੀ ਹੈ ਜਿਹਦੇ ਕਰਕੇ ਵਪਾਰਕ ਖੇਤਰ ਕੱਪੜੇ ਦੇ ਉੱਤੇ ਵੀ ਅਸਰ ਪੈ ਰਿਹਾ ਹੈ